ਹੈਲੋ ਬਸ ਵਧੀਆ ਤੂੰ ਸੁਣਾ ਬੜੇ ਦਿਨਾਂ ਬਾਅਦ ਯਾਦ ਕੀਤਾ ਯਾਰ ਕੁਛ ਨਹੀਂ ਕੀ ਪੁੱਛਣਾ ਮੈਂ ਮੈਡੀਕਲ ਕਰਕੇ ਅਤੇ ਹੁਣ ਮੈਂ ਕੋਈ ਮੈਡੀਕਲ ਕੋਲਜ ਲੱਭਦੀ ਪਈ ਹਾਂ ਤੂੰ ਦੱਸ ਕੋਈ ਮੈਡੀਕਲ ਕੋਲਜ ਵਧੀਆ ਜਿਹਾ ਹਾਂ ਹਾਂ ਹਾਂ ਹਾਂ ਪਰ ਯਾਰ ਉੱਥੇ ਕੀ ਪ੍ਰੋਸੈਸ ਹੈ ਕੀ ਮਤਲਬ ਫੀਸ ਵਗੈਰਾ ਦਾ ਕੀ ਹਿਸਾਬ ਕਿਤਾਬ ਆ ਅੱਛਾ ਚਲ ਚਲ ਠੀਕ ਆ ਮੈਂ ਨਾ ਫਿਰ ਮੈਂ ਮਿਲਦੀ ਹਾਂ ਤੈਨੂੰ ਕੱਲ੍ਹ ਫਿਰ ਆਪਾਂ ਚਲਦੇ ਹਾਂ ਪਤਾ ਕਰਦੇ ਹਾਂ

ਹਾਂ ਹਾਂ ਹਾਂ ਓਕੇ ਹਾਂ ਠੀਕ ਹੈ ਰੈਡੀ ਰਹੀ ਓਕੇ ਬਾਏ ਓਕੇ ਓਕੇ